ਮਿਠਾਈਆਂ ਵਿੱਚ ਜਿਵੇਂ ਗੁਲਾਬ ਜਾਮੁਨ ਕਾਜੂਕਤਲੀ ਬੇਸਨ ਦੇ ਲੱਡੂ ਬੁੰਦੀ ਦੇ ਲੱਡੂ ਸ਼ੱਕਰ ਪਾਰੇ ਗੁਲਾਬ ਜਾਮੁਨ ਰਸਗੁੱਲੇ ਪੇਸਟੀਆਂ ਇਹ ਚੀਜ਼ਾਂ ਮਿਠਾਈ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਹਨ